ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਅਤੇ ਪੰਜਾਬ ਵਿੱਚ ਇਹ ਮੇਰਾ ਜਨਮ ਹੋਇਆ ਹੈ ਪੰਜਾਬ ਵਿੱਚ ਵੱਡੀਆਂ ਸਰਕਾਰੀ ਸਕੀਮਾਂ ਅਤੇ ਜੋ ਵੀ ਪ੍ਰੋਗਰਾਮ ਹੈ ਉਹਨਾਂ ਦਾ ਉਦੇਸ਼ ਆਮ ਲੋਕਾਂ ਨੂੰ ਲਾਭ ਪਹੁੰਚਾਉਣ ਦਾ ਹੈ ਪੰਜਾਬ ਵਿੱਚ ਬਾਕੀ ਰਾਜਾਂ ਨਾਲੋਂ ਬਾਕੀ ਸਟੇਟਾਂ ਨਾਲੋਂ ਬਹੁਤ ਹੀ ਜ਼ਿਆਦਾ ਸੇਵਾਵਾਂ ਉਪਲਬਧ ਹਨ ਜਿਸ ਵਿੱਚ ਭਲਾਈ ਰੁਜ਼ਗਾਰ ਸਬੰਧੀ ਸਿੱਖਿਆ ਸਬੰਧੀ ਸਿਹਤ ਸੰਭਾਲ ਸਬੰਧੀ ਅਤੇ ਹੋਰ ਵੀ ਬੱਚਿਆਂ ਦੀਆਂ ਸ਼ਗੁਨ ਸਕੀਮਾਂ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਹੀ ਵਧੀਆ ਸਕੀਮਾਂ ਚੱਲਦੀਆਂ ਹਨ ਇਸ ਵਿੱਚ ਕਈ ਖਾਸ ਜਿੱਦਾਂ ਕਿ ਆਯੁਸ਼ਮਾਨ ਕਾਰਡ ਸਕੀਮ ਇਸ ਵਿੱਚ ਕਾਫੀ ਜ਼ਿਆਦਾ ਮਰੀਜ਼ਾਂ ਨੂੰ ਪੰਜ ਲੱਖ ਤੱਕ ਦਾ ਮੁਫਤ ਇਲਾਜ ਦਿੱਤਾ ਜਾਂਦਾ ਹੈ ਜਿਸ ਵਿੱਚ ਗਰੀਬ ਰਥ ਦੇ ਬੱਚਿਆਂ ਬਜ਼ੁਰਗਾਂ ਅਤੇ ਮਹਿਲਾਵਾਂ ਹਰ ਕਿਸੇ ਪਰਸਨ ਨੂੰ ਹਰ ਕਿਸੇ ਬੰਦੇ ਨੂੰ ਕਾਫੀ ਜ਼ਿਆਦਾ ਸਹੂਲਤ ਮਿਲੀ ਹੈ ਇਸ ਤੋਂ ਇਲਾਵਾ ਸ਼ਗੁਨ ਸਕੀਮ ਵਿੱਚ ਬੱਚਿਆਂ ਨੂੰ ਵਿਵਾਹਿਤ ਗਰੀਬ ਘਰ ਦੀ ਲੜਕੀ ਕੁੜੀਆਂ ਨੂੰ ਸ਼ਗੁਨ ਦੇ ਤਹਿਤ ਬਣਦਾ ਮੁਨਾਫਾ ਦਿੱਤਾ ਜਾਂਦਾ ਹੈ ਇਸ ਤੋਂ ਇਲਾਵਾ ਬੇਬੇ ਨਾਨਕੀ ਲਾਡਲੀ ਬੇਟੀ ਕਲਿਆਣ ਸਕੀਮ ਹੋਰ ਵੀ ਬਹੁਤ ਵਧੀਆ ਵਧੀਆ ਸਕੀਮਾਂ ਪੰਜਾਬ ਵਿੱਚ ਚਲਦੀਆਂ ਹਨ